ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਪੰਜਾਬ ਦੇ ਸਕੂਲਾਂ ਦੇ ਵਿੱਚ ਇੰਗਲਿਸ਼ ਅਤੇ ਹਿੰਦੀ 'ਤੇ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਅਤੇ ਪੇਂਡੂ ਬੱਚਿਆਂ ਦੇ ਵਿੱਚ ਵੀ ਇੰਗਲਿਸ਼ ਅਤੇ ਹਿੰਦੀ ਨੂੰ ਬੋਲਣ ਦਾ ਕਰੇਜ਼ ਦਿਨੋਂ ਦਿਨ ਵੱਧਦਾ ਰਿਹਾ ਜਿਸ ਕਰਕੇ ਪੰਜਾਬ ਦੇ ਜਿਹੜੇ ਬੱਚੇ ਹੈਗੇ ਉਹਨਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਗੀਤ ਅਤੇ ਆਦਿ ਵੀ ਬੱਚਿਆਂ ਨੂੰ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਪੰਜਾਬ ਦਾ ਜਿਹੜਾ ਭਾਸ਼ਾ ਆ ਗਈ ਪੰਜਾਬੀ ਅਤੇ ਉਹਨੂੰ ਵੀ ਸਿੱਖਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਅਤੇ ਪੰਜਾਬ ਦੇ ਸਾਰੇ ਅ ਪੰਜਾਬ ਦੇ ਸਾਰੇ ਖੇਤਰ ਜਿਵੇਂ ਲੁਧਿਆਣਾ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਿੰਦੀ ਚੰਡੀਗੜ੍ਹ ਪਟਿਆਲਾ ਹਿੰਦੀ ਅਤੇ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਅਤੇ ਪੰਜਾਬ ਦਾ ਜਿਹੜਾ ਦਿਨੋਂ ਦਿਨ ਪ੍ਰਤੀ ਦਿਨ ਪੰਜਾਬੀ ਭਾਸ਼ਾ ਕੀ ਆ ਪਛੜਦੀ ਜਾ ਰਹੀ ਹੈ ਪੰਜਾਬ ਦੇ ਲੋਕ ਆ ਜਿਹੜੇ ਆਪਣੇ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਆ ਤਾਂ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆ ਰਹੀ ਆ